ਪੰਛੀ ਸਾਡੇ ਇਨਵਾਇਰਮੈਂਟ ਲਈ ਬਹੁਤ ਜ਼ਿਆਦਾ ਸ ਜ਼ਰੂਰੀ ਹਨ ਸਾਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਖਾਸ ਕਰਕੇ ਮੋਬਾਈਲ ਫ਼ੋਨ ਅਤੇ ਇੰਟਰਨੈਟ ਦੀ ਘੱਟ ਯੂਜ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੰਛੀਆਂ ਨੂੰ ਖਤਮ ਕਰਨ ਦਾ ਮੁੱਖ ਕਾਰਨ ਹੈ ਸਾਨੂੰ ਇਹਨਾਂ ਲਈ ਅਨਾਜ ਅਤੇ ਪਾਣੀ ਵੀ ਰੱਖਣਾ ਚਾਹੀਦਾ ਹੈ ਹਰ ਚੌਂਕ 'ਤੇ ਅਤੇ ਆਪਣੇ ਘਰ ਦੀਆਂ ਛੱਤਾਂ 'ਤੇ ਵੀ ਪੰਛੀ ਨਾ ਹੋਣ ਤਾਂ ਸਾਡੇ ਇਨਵਾਇਰਮੈਂਟ 'ਤੇ ਬਹੁਤ ਅਸਰ ਪਵੇਗਾ ਅੱਜ ਦੇ ਦਿਨਾਂ ਵਿੱਚ ਪੰਛੀ ਬਹੁਤ ਹੀ ਘੱਟ ਗਏ ਹਨ ਅਤੇ ਇਨਵਾਇਰਮੈਂਟ ਵਿੱਚ ਬਹੁਤ ਹੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਪਲਿਊਸ਼ਨ ਵੀ ਬਹੁਤ ਵੱਧ ਰਿਹਾ ਹੈ ਅਤੇ ਹੋਰ ਵੀ ਕਈ ਤਰੀਕੇ ਦੀ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਹਰ ਇੱਕ ਜੀਵ ਜੋ ਧਰਤੀ 'ਤੇ ਆਇਆ ਹੈ ਉਸ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਰੀਸਰਕੂਲੇਸ਼ਨ ਹੋ ਸਕੇ ਅਤੇ ਸਾਨੂੰ ਪੰਛੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਹਨਾਂ ਲਈ ਦਾਣਾ ਪਾਣੀ ਰੱਖਣਾ ਚਾਹੀਦਾ ਹੈ ਹਰ ਚੌਂਕ ਗਲੀ ਮੁਹੱਲੇ ਅਤੇ ਆਪਣੇ ਘਰ ਦਿਆਂ ਕੋਠਿਆਂ 'ਤੇ ਪੰਛੀ ਨਾ ਹੋਣ ਤਾਂ ਸਾਡੇ ਜੀਵਨ 'ਤੇ ਬਹੁਤ ਗੂੜਾ ਅਸਰ ਪਵੇਗਾ ਇਸ ਲਈ ਸਾਨੂੰ ਪੰਛੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ